ਹਾਂ ਮੈਂ ਮੇਰੇ ਦੋਸਤਾਂ ਨਾਲ ਸਾਲਾਸਰ ਜਾਣ ਦੀ ਪਲੈ ਯਾਤਰਾ ਜਾਣ ਦੀ ਯਾਤਰਾ ਯਾਤਰਾ ਕੀਤੀ ਹੈ ਮੈਂ ਅਤੇ ਮੇਰੇ ਦੋਸਤ ਸਾਲਾਸਰ ਬਾਲਾ ਜੀ ਧਾਮ ਧਾਰਮਿਕ ਜਗ੍ਹਾ ਹੈ ਉੱਥੇ ਗਏ ਵਹਾਂ ਉੱਥੇ ਗਏ ਸੀ ਅਤੇ ਮੈਂ ਅਤੇ ਮੇਰੇ ਬੈਲੀ ਨੇ ਦਸ ਪੰਦਰਾਂ ਦਿਨ ਹੀ ਪਹਿਲਾਂ ਹੀ ਗੱ ਜਾਣ ਦੀ ਤਿਆਰੀ ਕਰ ਲਈ ਸੀ ਅਸੀਂ ਸੋਚ ਲਿਆ ਸੀ ਕਿ ਇਸ ਦਿਨ ਇਸ ਵਾਰ ਆਪਾਂ ਇੱਥੋਂ ਘਰੋਂ ਨਿਕਲ ਕੇ ਬਾਲਾ ਜੀ ਧਾਮ ਸਾਲਾਸਰ ਜਾਣ ਦੀ ਯਾਤ ਕ ਯਾਤਰਾ ਕਰਾਂਗੇ ਯਾਤਰਾ ਕਰਾਂਗੇ ਅਸੀਂ ਆਪਣੀ ਕਾਰ ਵਿੱਚ ਬੈਠ ਕੇ ਯਾਤਰਾ ਲਈ ਨਿਕਲ ਗਏ ਮੈਂ ਵੈਸੇ ਤਾਂ ਬਹੁਤ ਹੀ ਬਿਜ਼ੀ ਆਦਮੀ ਹਾਂ ਪਰ ਮੈਂ ਆਪਣੇ ਲਈ ਦਸ ਪੰਦਰਾਂ ਦਿਨ ਪਹਿਲਾਂ ਹੀ ਬ ਆਪਣੇ ਆਪਣੇ ਅਫਸਰ ਤੋਂ ਛੁੱਟੀ ਮੰਜੂਰ ਕਰਵਾ ਲਈ ਸੀ ਜਿਸ ਕਰ ਜਿਸ ਕਰਕੇ ਮੈਨੂੰ ਕੋਈ ਯਾਤਰਾ ਕਰਨ ਵਿੱਚ ਪਰੇਸ਼ਾਨੀ ਨਾ ਆਵੇ ਅਸੀਂ ਆਪਣੇ ਲਈ ਖਾਣ ਲਈ ਬਹੁਤ ਕੁਝ ਰੱਖ ਲਿਆ ਬਹੁਤ ਕੱਪੜੇ ਰੱਖ ਲਏ ਅਤੇ ਬਹੁਤ ਹੀ ਦਵਾਈਆਂ ਰੱਖ ਲਈਆਂ ਜਿਸ ਕਰਕੇ ਰਾਹਾਂ ਵਿੱਚ ਸਾਨੂੰ ਕੋਈ ਤਕਲੀਫ ਆਉਂਦੀ ਹੈ ਤਾਂ ਸਾਡੇ ਕੋਲ ਮੌਜੂਦਾ ਟਰੀਟਮੈਂਟ ਹੋਵੇ ਇਸ ਕਰਕੇ ਅਸੀਂ ਇਸ ਤਰ੍ਹਾਂ ਆਪਣੀ ਸਵਾਰੀ ਆਪਣੀ ਯਾਤਰਾ ਤਹਿ ਕੀਤੀ ਅਸੀਂ ਕੋਈ ਬਾਈਕ 'ਤੇ ਗਏ ਅਤੇ ਕੋਈ ਸ਼ਿਕਾਰ 'ਤੇ ਗਏ ਸਾਡੇ ਕੋਲ ਤਿੰਨ ਬਾਈਕਸ ਅਤੇ ਚਾਰ ਕਾਰ ਸੀ ਅਸੀਂ ਸਾਰੇ ਜਣੇ ਸਮੂਹ ਬਣਾ ਕੇ ਚਲੇ ਗਏ ਅਤੇ ਬਾਬਾ ਜੀ ਦੀ ਕਿਰਪਾ ਨਾਲ ਸਾਡੀ ਯਾਤਰਾ ਸਫ਼ਲ ਹੋ ਗਈ ਅਸੀਂ ਉੱਥੇ ਮੱਥਾ ਟੇਕਿਆ ਅਤੇ ਵਾਪਸ ਯਾਤਰਾ ਨਾਲ ਇੱਥੇ ਆ ਗਏ ਸਾਨੂੰ ਅਸੀਂ ਬਹੁਤ ਬਿਜ਼ੀ ਸੀ ਬਟ ਫਿਰ ਵੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਛੁੱਟੀ ਲੈ ਕੇ ਇਹ ਯਾਤਰਾ ਕਰਨ ਦੇ ਲਈ ਸੋਚਿਆ ਅਤੇ ਇਹ ਯਾਤਰਾ ਕਰਕੇ ਅਸੀਂ ਬਹੁਤ ਖੁਸ਼ ਹੋਏ